ਹਰ ਖੇਤਰ ਦੀ ਭਾਸ਼ਾ ਮੂਲ ਰੂਪ ਵਿੱਚ ਇੱਕ ਰਹਿੰਦੀ ਹੈ ਜਿੱਦਾਂ ਜਿੱਦਾਂ ਅਸੀਂ ਉਹਦੇ ਅੱਗੇ ਵਧਦੇ ਜਾਂਦੇ ਨੇ ਭਾਸ਼ਾ ਦਾ ਬੋਲਣ ਦਾ ਤਰੀਕਾ ਥੋੜ੍ਹਾ ਥੋੜ੍ਹਾ ਫਰਕ ਹੁੰਦਾ ਜਾਂਦਾ ਹੈ ਪਰ ਇਹਦੇ ਨਾਲ ਭਾਸ਼ਾ ਦੇ ਮੂਲ ਰੂਪ ਵਿੱਚ ਕੋਈ ਫਰਕ ਨਹੀਂ ਪੈਂਦਾ ਜਿਹੜੀ ਭਾਸ਼ਾ ਬੰਗਾਲੀ ਅਤੇ ਬੋਡੋ ਇਹਦੇ ਅਤੇ ਪੰਜਾਬੀ ਭਾਸ਼ਾ ਵਿੱਚ ਬਹੁਤ ਫਰਕ ਹੈਗਾ ਨਾ ਇਹਦੀ ਲਿਪੀ ਮਿਲਦੀ ਹੈ ਨਾ ਬੋਲਣ ਦਾ ਤਰੀਕਾ ਮਿਲਦਾ ਹੈ ਪੰਜਾਬ ਦੇ ਅੰਦਰ ਹੀ ਤੁਸੀਂ ਪੰਜਾਬੀ ਦੇ ਵੱਖ ਵੱਖ ਤਰੀਕੇ ਦੇਖ ਸਕਦੇ ਹੋ ਪਰ ਕਿਸੇ ਵੀ ਤਰੀ ਖੇਤਰ 'ਤੇ ਬੋਡੋ ਜਾਂ ਬੰਗਾਲੀ ਬ ਭਾਸ਼ਾ ਇੱਥੇ ਨਹੀਂ ਬੋਲੀ ਜਾਂਦੀ